ਵੈਸੇ ਤਾਂ ਅਗਰ ਗੱਲ ਕੀਤੀ ਜਾਵੇ ਪੇਂਡੂ ਖੇਤਰਾਂ ਦੇ ਵਿੱਚ ਜਾਂ ਹੋਸਪਿਟਲਾਂ ਦੇ ਵਿੱਚ ਤਾਂ ਜਿਹੜੇ ਲੇਡੀਜ਼ ਪ੍ਰੈਗਨੈਂਟ ਹੁੰਦੀਆਂ ਹਨ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਸਹੂਲਤਾਂ ਪ੍ਰਾਪਤ ਹੁੰਦੀਆਂ ਹਨ ਅਤੇ ਉਹਨਾਂ ਨੂੰ ਆਪਣੀ ਸਰਕਾਰ 'ਤੇ ਅਤੇ ਆਪਣੇ ਪਿੰਡ ਦੇ ਜਿਹੜੇ ਖੇਤਰ ਹਸਪਤਾਲ ਇਹ ਬਹੁਤ ਜ਼ਿਆਦਾ ਹੀ ਸਹੂਲਤਾਂ ਦਿੰਦੇ ਹਨ ਜਿਵੇਂ ਕਿ ਸਭ ਤੋਂ ਪਹਿਲਾਂ ਉਹਨਾਂ ਦੇ ਜਿਹੜੇ ਟੈਸਟ ਹੁੰਦੇ ਹਨ ਉਹ ਫ਼ਰੀ ਹੁੰਦੇ ਹਨ ਅਤੇ ਦੂਜੇ ਨੰਬਰ 'ਤੇ ਉਹਨਾਂ ਦਾ ਇੱਕ ਕਾਰਡ ਬਣਦਾ ਹੈ ਬੱਚੇ ਵਾਲਾ ਅਤੇ ਉਹ ਆਪਣਾ ਦੋ ਮਹੀਨਾਂ ਦਾ ਬਾਅਦ ਹਫ਼ਤੇ ਵਾਲਾ ਟੈਸਟ ਉਹਨਾਂ ਦਾ ਹੁੰਦਾ ਹੈ ਉਹ ਵੀ ਫ਼ਰੀ ਹੁੰਦਾ ਹੈ ਹੋਰ ਵੀ ਕਈ ਤਰ੍ਹਾਂ ਦੀ ਸਹੂਲਤਾਂ ਹਨ